ਅਸੀਂ ਆਪਣਾ ਖਾਣਾ ਵਿ ਪਕਾਉਣ ਵਿੱਚ ਜੜ੍ਹੀ ਬੂਟੀਆਂ ਜਿਵੇਂ ਅਸੀਂ ਕੜੀ ਪੱਤਾ ਇਮਲੀ ਪੁਦੀਨਾ ਆਦਿ ਚੀਜ਼ਾਂ ਦੀ ਵਰਤੋਂ ਕਰ ਸਕਦੇ ਹਾਂ ਕੜੀ ਪੱਤੇ ਦੀ ਵਰਤੋਂ ਅਸੀਂ ਕੜੀ ਪੱਤੇ ਨੂੰ ਅਸੀਂ ਕੁੱਟ ਕੇ ਪੇਸਟ ਬਣਾ ਕੇ ਅਸੀਂ ਸਬਜ਼ੀਆਂ ਵਿੱਚ ਪਾ ਸਕਦੇ ਅਸੀਂ ਕੜੀ ਬਣਾਉਣ ਬਣਾੳ ਬਣਾਉਂਦੇ ਹਾਂ ਜਿਸ ਕਰਕੇ ਸਾਨੂੰ ਕੜੀ ਦਾ ਟੇਸਟ ਵਧੀਆ ਆਵੇ ਹਰੇਕ ਸਬਜ਼ੀ ਦਾ ਟੇਸਟ ਵਧੀਆ ਆਵੇ ਅਤੇ ਅਸੀਂ ਇਮਲੀ ਦੀ ਵਰਤੋਂ ਵੀ ਕਰ ਇਮਲੀ ਨੂੰ ਅਸੀਂ ਕਿਸੇ ਵੀ ਤਰੀਕੇ ਨਾਲ ਖਾ ਸਕਦੇ ਹਾਂ ਇਮਲੀ ਦੀ ਵਰਤੋਂ ਅਸੀਂ ਹਰੇਕ ਸਬਜ਼ੀਆਂ ਵਿੱਚ ਕਰਦੇ ਹਾਂ ਜਿਸ ਕਰਕੇ ਸਬਜ਼ੀ ਦਾ ਟੇਸਟ ਬਹੁਤ ਵਧੀਆ ਆਵੇ ਅਤੇ ਅਸੀਂ ਪੁਦੀਨੇ ਦੀ ਵਰਤੋਂ ਵੀ ਕਰਦੇ ਹਾਂ ਪੁਦੀਨਾ ਸਾਡੇ ਸਰੀਰ ਲਈ ਬਹੁਤ ਹੀ ਲਾਭਦਾਇਕ ਹੈ ਇਸ ਦੀ ਵਰਤੋਂ ਅਸੀਂ ਠੰਡਿਆਈ ਵਿੱਚ ਕਰਦੇ ਹਾਂ ਅਤੇ ਸਬਜ਼ੀਆਂ ਵਿੱਚ ਵੀ ਕਰਦੇ ਹਾਂ ਇਸਦੀ ਬਰਸੋ ਅ ਪੁਦੀਨੇ ਦੀ ਵਰਤੋਂ ਅਸੀਂ ਚਟਣੀ ਬਣਾਉਣ ਵਾਸਤੇ ਵੀ ਕਰਦੇ ਹਾਂ ਇਹ ਸਾਡੇ ਸਰੀਰ ਨੂੰ ਠੰਡਕ ਦਿੰਦੀ ਹੈ ਜਿਸ ਕਰਕੇ ਸਾਡਾ ਸਰੀਰ ਬਹੁਤ ਹੀ ਵਧੀਆ ਰਹਿੰਦਾ ਹੈ ਅਤੇ ਅਸੀਂ ਹਰੇਕ ਬਿਮਾਰੀਆਂ ਤੋਂ ਦੂਰ ਰਹਿੰਦੇ ਹਾਂ ਇਸ ਲਈ ਸਾਨੂੰ ਇਹਨਾਂ ਚੀਜ਼ਾਂ ਦੀ ਵਰਤੋਂ ਕਰਨੀ ਚਾਹੀਦੀ ਹੈ ਅਤੇ ਸਾਨੂੰ ਵਧੀਆ ਵਧੀਆ ਜੜ੍ਹੀ ਬੂਟੀਆਂ ਦੀ ਵਰਤੋਂ ਕਰਨੀ ਚਾਹੀਦੀ ਹੈ ਜੋ ਸਾਡੇ ਸਰੀਰ ਲਈ ਬਹੁਤ ਹੀ ਲਾਭਦਾਇਕ ਹਨ